ਭਾਰਤੀ ਨੌਕਰੀ ਬਜ਼ਾਰ ਦੇ ਵਿੱਚ ਬਹੁਤ ਸਾਰੀਆਂ ਸੰਭਾਵਨਾ ਹਨ ਅਤੇ ਬਹੁਤ ਸਾਰੀਆਂ ਨੌਕਰੀਆਂ ਬਹੁਤ ਸਾਰੇ ਕੰਮ ਇਸ ਵਿੱਚ ਛੁਪੇ ਹੋਏ ਹਨ ਪਰੰਤੂ ਉਹਨਾਂ ਬਾਰੇ ਨਾ ਬਹੁਤੀ ਜਾਣਕਾਰੀ ਹੋਣ ਕਰਕੇ ਕਈ ਵਾਰੀ ਨਵੇਂ ਪੜ੍ਹਨ ਵਾਲੇ ਵਿਦਿਆਰਥੀ ਚੁਣੌਤੀਆਂ ਦਾ ਸਾਹਮਣਾ ਕਰਦੇ ਹਨ ਅਤੇ ਉਹਨਾਂ ਨੂੰ ਇਹ ਸਮਝ ਨਹੀਂ ਆਉਂਦੀ ਅਸੀਂ ਕਿਹੜੇ ਕਿੱਤੇ ਨੂੰ ਚੁਣੀਏ ਅਤੇ ਸਾਡੇ ਕਿੱਤੇ ਬਹੁਤ ਹਨ ਪਰੰਤੂ ਉਹਨਾਂ ਦੀ ਜਾਣਕਾਰੀ ਨਾ ਹੋਣ ਕਰਕੇ ਸਾਡੇ ਨੌਜਵਾਨਾਂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਨੌਕਰੀਆਂ ਦੇ ਵਿੱਚ ਹਰ ਵਰਗ ਦੇ ਜਿਹੜੇ ਲੋਕ ਨੇ ਉਹ ਸ਼ਾਮਿਲ ਹੋ ਸਕਦੇ ਨੇ ਅਤੇ ਜਿਹੜੇ ਹੱਥਾਂ ਦੇ ਧੰਦੇ ਨੇ ਜਾਂ ਆਪਣੇ ਲੋਕਲ ਧੰਦੇ ਨੇ ਉਹ ਵੀ ਕੀਤੇ ਜਾ ਸਕਦੇ ਨੇ ਅਤੇ ਪਰੰਤੂ ਜਿਹੜੇ ਲੋਕ ਨੇ ਉਹ ਚਾਹੁੰਦੇ ਨੇ ਵੀ ਸ਼ਾਇਦ ਸਾਨੂੰ ਕੋਈ ਡਿਗਰੀ ਹਾਸਲ ਕਰਕੇ ਨੌਕਰੀਆਂ ਦਏ ਜਾਂ ਅਸੀਂ ਕਿਸੇ ਕੰਮ ਜਾਂ ਸਕਿੱਲ ਦੇ ਯੋਗ ਹੋ ਜਾਵਾਂਗੇ ਉਹ ਜ਼ਰੂਰੀ ਕਿਸੇ ਹੱਦ ਤੱਕ ਹੈ ਪਰੰਤੂ ਸਕਿੱਲ ਜਿਹੜੀ ਹੈ ਉਹ ਘਰਾਂ ਵਿੱਚੋਂ ਵੀ ਜਾਂ ਪਿਤਾ ਪੁਰਖੀ ਵੀ ਸਿੱਖੀ ਜਾ ਸਕਦੀ ਹੈ ਅਤੇ ਉਸ ਨੂੰ ਹੋਰ ਫਾਈਨ ਬਣਾਇਆ ਜਾ ਸਕਦਾ ਹੈ ਇਸ ਤਰੀਕੇ ਨਾਲ ਜਿਹੜੀ ਇਹ ਸਾਡੇ ਨੌਕਰੀਆਂ ਦਾ ਜਿਹੜਾ ਭਾਰਤੀ ਬਜ਼ਾਰ ਆ ਉਹਦੇ ਵਿੱਚ ਹੋਰ ਵਾਧਾ ਹੋ ਸਕਦਾ ਹੈ ਅਤੇ ਉਸ ਬਾਰੇ ਚੇਤਨਤਾ ਦੀ ਲਿਆਉਣ ਦੀ ਬਹੁਤ ਲੋੜ ਹੈ ਜੀ